ਸਤਿ ਸ਼੍ਰੀ ਅਕਾਲ ਸਰ ਸਰ ਨਾਗਪੁਰ ਢਾਬੇ ਤੋਂ ਬੋਲਦੇ ਹੋ ਜੀ ਸਰ ਮੈਂ ਨੀ ਆਪਣੇ ਢਾਬੇ ਤੋਂ ਮਟਰ ਪਨੀਰ ਔਡਰ ਕਰਿਆ ਸੀਗਾ ਮੈਂ ਬਡੂੰਗਰ ਤੋਂ ਬੋਲ ਰਿਹਾ ਮਾਨਵ ਅਤੇ ਮੇਰਾ ਜਨਮ ਦਿਨ ਸੀ ਅੱਜ ਅਤੇ ਇਸ ਲਈ ਮੈਂ ਮਟਰ ਪਨੀਰ ਔਡਰ ਕਰਿਆ ਸੀਗਾ ਅਤੇ ਮੈਂ ਔਡਰ ਕਰਿਆ ਸੀਗਾ ਜੀ ਮੈਂ ਪਹਿਲੇ ਤੁਹਾਨੂੰ ਇਹ ਗੱਲ ਕਹੀ ਸੀ ਵੀ ਨੂਣ ਅਤੇ ਮਿਰਚਾਂ ਅਤੇ ਤੇਲ ਘੱਟ ਹੋਵੇ ਅਸੀਂ ਬਹੁਤ ਘੱਟ ਖਾਂਦੇ ਆ ਜੀ ਅਤੇ ਔਡਰ ਵੀ ਬਿਲਕੁਲ ਟਾਈਮ 'ਤੇ ਆ ਗਿਆ ਸੀਗਾ ਸਹੀ ਟਾਈਮ 'ਤੇ ਮੁੰਡਾ ਫੜਾ ਗਿਆ ਸੀ ਚਲੋ ਜੀ ਅਸੀਂ ਖੋਲਿਆ ਖਾਣ ਬੈਠੇ ਉਦੋਂ ਪਹਿਲਾਂ ਤਾਂ ਉ ਚੋਂ ਮੁਸ਼ਕ ਜੀ ਮਾਰੇ ਜੀ ਚਲੋ ਮੈਂ ਬੁਰਕੀ ਲਾਈ ਬੁਰਕੀ ਲਾਂਦੇ ਸਾਰ ਇੰਨੀ ਤੇਜ਼ ਮਿਰਚਾਂ ਜੀ ਨੂਣ ਵੀ ਇੰਨਾ ਤੇਜ਼ ਪਾ ਰੱਖਿਆ ਤੁਸੀਂ ਵੀ ਐਨਾਂ ਬੁਰਾ ਹਾਲ ਹੋ ਗਿਆ ਸੀ ਉੱਠ ਕੇ ਮੈਂ ਪਾਣੀ ਦਾ ਗਲਾਸ ਪੀਤਾ ਜੀ ਤਾਂ ਜਾ ਕੇ ਮੈਨੂੰ ਆਰਾਮ ਮਿਲਿਆ ਥੋੜ੍ਹਾ ਤੁਸੀਂ ਸਰ ਮੈਂ ਪਹਿਲੀ ਬੇਨਤੀ ਕਰਕੇ ਇਹ ਚੀਜ਼ ਕਹੀ ਸੀ ਨਾ ਵੀ ਆਪਣਾ ਨੂਣ ਮਿਰਚਾਂ ਜਾਂ ਤੇਲ ਘੱਟ ਹੋਵੇ ਤੁਸੀਂ ਫਿਰ ਵੀ ਐਨਾਂ ਤੇਜ਼ ਪਾ ਕੇ ਭੇਜ ਦਿੱਤਾ ਜਦ ਆਪਣੇ ਕੋਲ ਚੀਜ਼ ਨਹੀਂ ਹੈਗੀ ਜੀ ਆਪਾਂ ਜਵਾਬ ਦੇ ਦੇਈਏ ਵੀ ਹੈ ਨਹੀਂ ਮੇਰੇ ਕੋਲ ਬਾਈ ਆਹ ਚੀਜ਼ ਨਾ ਤੁਸੀਂ ਹੋਰ ਕਿਤੋਂ ਔਡਰ ਕਰ ਲਉ ਜਾਂ ਆਪਾਂ ਕਹੀਏ ਵੀ ਸਾਡੇ ਹਜੇ ਅਵੇਲੇਬਲ ਨਹੀਂ ਬਾਅਦ 'ਚ ਤੁਸੀਂ ਔਡਰ ਕਰ ਲਿਓ ਤਾਂ ਮੈਂ ਕਿਤੋਂ ਹੋਰ ਹੀ ਔਡਰ ਕਰ ਲੈਂਦਾ ਜੀ ਚਲੋ ਹੈ ਨਾ ਆਪਣੇ ਤੋਂ ਤੁਸੀਂ ਫਿਰ ਵੀ ਐਨੀ ਤੇਜ਼ ਨੂਣ ਮਿਰਚ ਪਾ ਕੇ ਭੇਜ ਦਿੱਤਾ ਜੀ ਆ ਤਾਂ ਹੁਣ ਮੇਰੀ ਤੁਹਾਨੂੰ ਬੇਨਤੀ ਆ ਵੀ ਜਾਂ ਇਹਨੂੰ ਵਾਪਸ ਕਰਾ ਲਉ ਜਾਂ ਇਹਦੀ ਥਾਂ ਤੁਹਾਡੇ ਕੋਲ ਕੋਈ ਹੋਰ ਵੀ ਆਈਟਮ ਹੈਗੀ ਆ ਪਨੀਰ ਦੀ ਜੀਦੇ 'ਚ ਨੂਣ ਮਿਰਚਾਂ ਤੇਲ ਘੱਟ ਹੋਵੇ ਉਹ ਤੁਸੀਂ ਮੈਨੂੰ ਉਹ ਭੇਜ ਦਿਓ ਆਹ ਬੇਨਤੀ ਆ ਤੁਹਾਨੂੰ ਜੀ ਹੁਣ ਇਹ ਚੀਜ਼ ਨੂੰ ਵਾਪਸ ਕਰਾ ਲਓ ਸਾਰੇ ਟੱਬਰ ਦਾ ਤੁਸੀਂ ਮੂਡ ਖਰਾਬ ਕਰ ਰੱਖਿਆ